ਫੋਟੋਗ੍ਰਾਫਰੀ ਦਾ ਸ਼ੌਕ ਹਰ ਕਿਸੇ ਨੂੰ ਅੰਦਰੋਂ ਅੰਦਰ ਹੁੰਦਾ ਹੈ ਉਹ ਪਰ ਕੋਈ ਆਪਣੇ ਕੈਮਰੇ 'ਚ ਮੋਬਾਈਲ 'ਚ ਕਿਸੇ ਤਰ੍ਹਾਂ ਵੀ ਉਹ ਰੱਖ ਸਕਦਾ ਹੈ ਉਹ ਬਾਹਰ ਜਾਣ ਦੀ ਪਹਾੜਾਂ 'ਤੇ ਸੈਰ ਕਰਨ ਜਾਂਦੇ ਹਨ ਰੇਲਵੇ 'ਚ ਜਾਂਦੇ ਹਨ ਬੱਸ ਸਟੈਂਡ ਜਾਂਦੇ ਹਨ ਬਾਜ਼ਾਰ 'ਚ ਜਾਂਦੇ ਹਨ ਸਕੂਲ ਕਾਲਜ ਦੇ ਵਿੱਚ ਫੰਕਸ਼ਨ ਹੁੰਦਾ ਹੈ ਹੋਰ ਗਤੀਵਿਧੀਆਂ ਹੁੰਦੀਆਂ ਹਨ ਸਮਾਜਿਕ ਰਾਜਨੀਤਿਕ ਹੁੰਦੀਆਂ ਹਨ ਜਿਹਦੇ 'ਚ ਫੋਟੋਗਰਾਫੀ ਦਾ ਸ਼ੌਕ ਰੱਖਣ ਵਾਲੇ ਬੰਦੇ ਅਲੱਗ ਅਲੱਗ ਮੌਕਿਆਂ ਦੇ ਮੌਕਾ ਦੇਖ ਕੇ ਹੀ ਫੋਟੋਆਂ ਲੈ ਲੈਂਦੇ ਹਨ ਉਹਨਾਂ ਨੂੰ ਸ਼ੌਕ ਹੁੰਦਾ ਹਨ ਉਹਨਾਂ ਨੂੰ ਇਹ ਯਾਦਗਿਰੀ ਆਪਣੀ ਲਾਇਬਰੇਰੀ 'ਚ ਐਲਬਮ 'ਚ ਰੱਖਦੇ ਹਨ ਅਤੇ ਮੌਕੇ ਮੌਕੇ 'ਤੇ ਉਹ ਕਿਸੇ ਦੂਸਰੇ ਨੂੰ ਵੀ ਦੱਸਦੇ ਹਨ ਅਤੇ ਉਹ ਰਿਕਾਰਡ ਦੇ ਵਿੱਚ ਰਹਿੰਦੀ ਹੈ